ਮੌਜੂਦਾ ਸਮੇਂ ਦੇ ਵਿੱਚ ਪੌਦਿਆਂ ਨੂੰ ਪੈਦਾ ਕਰਨ ਵਾਸਤੇ ਜਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਇਸ ਪ੍ਰਕਾਰ ਹਨ ਜਿਸ ਤਰ੍ਹਾਂ ਕਿ ਕੋਈ ਪਹਿਲਾਂ ਪੌਦਾ ਲੱਗਿਆ ਹੋਇਆ ਹੈ ਉਹਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਉਸਦੇ ਉੱਤੇ ਬੇਲ ਚੜ੍ਹਾਉਣੀ ਉਸ ਬੇਲ ਨੂੰ ਅਸੀਂ ਦੇਸੀ ਖਾਦ ਪਾਉਣੀ ਅੰਗਰੇਜ਼ੀ ਖਾਦ ਪਾਉਣੀ ਅਤੇ ਪਾਣੀ ਦੀ ਵਰਤੋਂ ਕਰਨੀ ਉਹਦੇ ਨਾਲ ਸਾਨੂੰ ਬਹੁਤ ਨਜ਼ਾਰਾ ਆਉਂਦਾ ਹੈ